ਸਾਡੇ ਇਲਾਕੇ ਵਿੱਚ ਖੇਤੀਬਾੜੀ ਜ਼ਿਆਦਾਤਰ ਹੜ੍ਹ ਜਾਂ ਫਿਰ ਸੋਕੇ ਕਰਕੇ ਪ੍ਰਭਾਵਿਤ ਹੁੰਦੀ ਹੈ ਕਦੀ ਬਾਰਸ਼ ਜ਼ਿਆਦਾ ਹੋ ਜਾਂਦੀ ਹੈ ਜਿਸ ਕਰਕੇ ਹੜ੍ਹ ਆ ਜਾਂਦੇ ਹਨ ਅਤੇ ਕਦੀ ਬਾਰਸ਼ ਬਹੁਤ ਘੱਟ ਹੁੰਦੀ ਹੈ ਜਿਸ ਕਰਕੇ ਸੋਕਾ ਪੈ ਜਾਂਦਾ ਹੈ ਹੜ੍ਹ ਅਤੇ ਸੋਕਾ ਸੋਕੇ ਕਰਕੇ ਫਸਲ ਦੀ ਦਾ ਉਤਪਾਦਨ ਘੱਟ ਜਾਂਦਾ ਹੈ ਜਿਸ ਨਾਲ ਕਿਸਾਨਾਂ ਵਾਸਤੇ ਕਾਫੀ ਮੁਸ਼ਕਿਲ ਬਣ ਜਾਂਦੀ ਹੈ ਕਿਸਾਨ ਇਸ ਰੁਕਾਵਟ ਨੂੰ ਬਚ ਤਾਂ ਨਹੀਂ ਸਕਦੇ ਪਰ ਆਪਣੇ ਨੁਕਸਾਨ ਨੂੰ ਪੂਰਾ ਕਰਨ ਵਾਸਤੇ ਜਾਂ ਤਾਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਦੇ ਹਨ ਅਤੇ ਜਾਂ ਆਪਣੇ ਘਾਟੇ ਨੂੰ ਪੂਰਾ ਕਰਨ ਵਾਸਤੇ ਕਰਜ਼ੇ ਲੈ ਕੇ ਆਪਣਾ ਗੁਜ਼ਾਰਾ ਕਰਦੇ ਹਨ ਕਿਸਾਨਾਂ ਨੂੰ ਹੜ੍ਹ ਹੋਵੇ ਜਾਂ ਸੋਕਾ ਦੋਨਾਂ ਹੀ ਸਮੱਸਿਆਵਾਂ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਜੇ ਸੋਕਾ ਪੈ ਜਾਵੇ ਤਾਂ ਪਾਣੀ ਵਾਸਤੇ ਕਿਸਾਨਾਂ ਨੂੰ ਟਿਊਬਵੈੱਲ ਜ਼ਿਆਦਾ ਦੇਰ ਚਲਾਉਣੇ ਪੈਂਦੇ ਹਨ ਜਿਸ ਕਰਕੇ ਉਹਨਾਂ ਦਾ ਬਿਜਲੀ ਦਾ ਖਰਚਾ ਵਧ ਜਾਂਦਾ ਹੈ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਕਾਫ਼ੀ ਮੁਸ਼ਕਲਾਂ ਭਰੀ ਬਣ ਜਾਂਦੀ ਹੈ